ਮੈਂ ਬਿਸ਼ਨ ਸਿੰਘ ਪਿੰਡ ਖਾਨੇਵਾਲ ਦਾ ਰਹਿਣ ਵਾਲਾ ਹਾਂ ਮੈਂ ਆਪਣੀ ਝੋਨੇ ਦੀ ਫਸਲ ਲਈ ਫਸਲ ਬੀਮਾ ਤਹਿਤ ਇੱਕ ਅਰਜ਼ੀ ਕੁਝ ਦਿਨ ਪਹਿਲਾਂ ਤੁਹਾਡੇ ਦਫਤਰ ਭੇਜੀ ਸੀ ਉਹ ਅਰਜ਼ੀ ਦਾ ਜਵਾਬ ਮੈਨੂੰ ਅਜੇ ਤੱਕ ਨਹੀਂ ਮਿਲਿਆ ਹੈ ਇਸ ਕਰਕੇ ਮੈਨੂੰ ਕੋਈ ਢੁੱਕਵਾਂ ਜਵਾਬ ਦੇਣ ਦੀ ਕ੍ਰਿਪਾਲਤਾ ਕਰੋ ਕਿਉਂਕਿ ਮੈਨੂੰ ਆਪਣੀ ਫਸਲ ਲਈ ਉਸ ਬੀਮੇ ਦੀ ਬਹੁਤ ਜ਼ਰੂਰਤ ਹੈ ਮੇਰੀ ਮਾਲੀ ਹਾਲਤ ਵੀ ਕੁਝ ਠੀਕ ਨਹੀਂ ਹੈ ਅਤੇ ਜੇਕਰ ਤੁਹਾਡੇ ਵੱਲੋਂ ਉਹ ਫਸਲ ਬੀਮਾ ਅਰਜ਼ੀ ਮਨਜ਼ੂਰ ਕਰ ਲਈ ਜਾਵੇ ਅਤੇ ਮੇਰੀ ਕੁਝ ਮਦਦ ਹੋ ਜਾਵੇਗੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਅਰਜ਼ੀ ਨੂੰ ਮਨਜ਼ੂਰ ਕਰ ਦਿਓ